ਮੇਰਾ ਨਾਮ ਅੰਮ੍ਰਿਤਪਾਲ ਸਿੰਘ ਹੈ ਮੈਂ ਪਿੰਡ ਕਬੈੜੀ ਦਾ ਰਹਿਣ ਵਾਲਾ ਹਾਂ ਮੇਰੇ ਘਰ ਵਿੱਚ ਛੇ ਤੋਂ ਸੱਤ ਸਦੱਸਯ ਹਨ ਅਤੇ ਮੈਂ ਹੁਣੀ ਹੁਣੀ ਬਾਰ੍ਹਵੀਂ ਪਾਸ ਕੀਤੀ ਹੈ ਅਤੇ ਅੱਗੇ ਹੁਣ ਮੈਂ ਆਪਣਾ ਬਿਜ਼ਨਸ ਤੋਰਨਾ ਹੈ ਜਿਸ ਵਿੱਚ ਫਾਰਮਿੰਗ ਦਾ ਕੰਮ ਡੈਅਰੀ ਫਾਰਮਿੰਗ ਦਾ ਕੰਮ ਮੈਂ ਚਲਾਉਣ ਲੱਗਿਆ ਹਾਂ ਇਸ ਵਿੱਚ ਘਰ ਦੇ ਵੀ ਫੁੱਲ ਸਪੋਰਟ ਕਰ ਰਹੇ ਹਨ ਅਤੇ ਸ਼ਾ ਹੁਣ ਮੈਂ ਆਪਣਾ ਦੁੱਧ ਨੇੜੇ ਪੈਂਦੇ ਸ਼ਹਿਰ ਮੋਹਾਲੀ ਵਿੱਚ ਲਗਾ ਵੀ ਲਿਆ ਹੈ ਅਤੇ ਉੱਥੇ ਵਧੀਆ ਕੰਮ ਚੱਲ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਮੇਰੀਆਂ ਵੱਡੀਆਂ ਵੱਡੀਆਂ ਡੈਅਰੀਆਂ ਹੋਣਗੀਆਂ ਜਿੰਨੀ ਮੈਂ ਮਿਹਨਤ ਕਰਾਂਗਾ ਉੱਨਾਂ ਹੀ ਮੈਂ ਫਲ਼ ਪਾਵਾਂਗਾ ਅਤੇ ਮੈਨੂੰ ਹੋਕੀ ਖੇਡਣ ਦਾ ਬਹੁਤ ਸ਼ੌਕ ਹੈ ਅਤੇ ਯੋਗਾ ਕਰਨ ਦਾ ਵੀ ਬਹੁਤ ਸ਼ੌਕ ਹੈ ਸਵੇਰੇ ਪੰਜ ਵਜੇ ਉੱਠ ਕੇ ਮੈਂ ਯੋਗਾ ਕਰਦਾ ਹਾਂ ਸੈਰ ਕਰਨ ਜਾਂਦਾ ਹਾਂ ਅਤੇ ਮੈਂ ਤਲ਼ੀਆਂ ਹੋਈਆਂ ਚੀਜ਼ਾਂ ਛੱਡ ਕੇ ਮੈਂ ਹਰੀਆਂ ਸਬਜ਼ੀਆਂ ਜ਼ਿਆਦਾ ਖਾਂਦਾ ਹਾਂ ਜਿਸ ਨਾਲ਼ ਸਰੀਰ ਬਹੁਤ ਹੀ ਤੰਦਰੁਸਤ ਰਹਿੰਦਾ ਹੈ ਅਤੇ ਅੱਗੇ ਵੀ ਮੈਂ ਲੋਕਾਂ ਨੂੰ ਇਹ ਹੀ ਸਲਾਹ ਦਿੰਦਾ ਹਾਂ ਕਿ ਤੁਸੀਂ ਇਹ ਖਾਓ ਹਰੀਆ ਸਬਜ਼ੀਆਂ ਅਤੇ ਹਮੇਸ਼ਾ ਮੈਂ ਮੋਟਰਸਾਈਕਲ ਚਾਲ਼ੀ ਤੋਂ ਪੰਜਾਹ ਦੀ ਸਪੀਡ 'ਚ ਹੀ ਚਲਾਉਂਦਾ ਹਾਂ ਚਾਹੇ ਮੈਨੂੰ ਜਿੰਨੀ ਮਰਜ਼ੀ ਕਾਹਲੀ ਹੋਵੇ ਕਿਉਂਕਿ ਇਸ ਆਪਣੀ ਵੀ ਇਸ ਨਾਲ਼ ਸੁਰੱਖਿਆ ਹੁੰਦੀ ਹੈ ਅਗਲੇ ਵੀ ਸੁਰੱਖਿਆ ਹੁੰਦੀ ਹੈ ਮੈਂ ਆਪਣੀ ਇੱਕ ਹੋਰ ਮਸ਼ਹੂਰ ਗੱਲ ਦੱਸਦਾ ਹਾਂ ਜਿੱਥੇ ਵੀ ਮੈਨੂੰ ਮੌਕਾ ਮਿਲਦਾ ਹੈ ਮੈਂ ਲੋਕਾਂ ਦੇ ਅੱਗੇ ਵੱਧ ਮਦਦ ਕਰਦਾ ਹਾਂ ਜਿਸ ਜਿੱਥੇ ਵੀ ਮੈਨੂੰ ਦਿੱਖਦਾ ਹੈ ਵੀ ਫ਼ਲਾਣਾ ਬੰਦਾ ਮੁਸੀਬਤ 'ਚ ਹੈ ਮੇਰਾ ਯਾਰ ਦੋਸਤ ਮੇਰੀ ਮੁਸੀਬਤ 'ਚ ਹੈ ਉਸ ਨਾਲ਼ ਉਸ ਨੂੰ ਮੈਂ ਮੁਸੀਬਤ ਚੋਂ ਕੱਢਦਾ ਹਾਂ ਜਿੱਥੋਂ ਤੱਕ ਮੇਰੇ ਤੋਂ ਹੁੰਦਾ ਹੈ ਮੈਂ ਉਸਦੀ ਮਦਦ ਕਰਦਾ ਹਾਂ ਅਤੇ ਮੈਨੂੰ ਬੜ ਮੈਂ ਬੜਿਆ ਦਾ ਆਦਰ ਬਹੁਤ ਜ਼ਿਆਦਾ ਕਰਦਾ ਹਾਂ ਅਤੇ ਹਰੇਕ ਨੂੰ ਮੈਂ ਪਿੰਡ ਵਿੱਚ ਰਿਸ਼ਤੇਦਾਰੀ ਵਿੱਚ ਸਤਿ ਸ਼੍ਰੀ ਅਕਾਲ ਬੁਲਾ ਕੇ ਉਹਨਾਂ ਦੇ ਵੱਡਿਆਂ ਦੇ ਬਜ਼ੁਰਗਾਂ ਦੇ ਪੈਰ ਹੱਥ ਲਾਉਂਦਾ ਹਾਂ ਜਿਸ ਨਾਲ਼ ਬਹੁਤ ਹੀ ਜ਼ਿਆਦਾ ਮੈਨੂੰ ਅਸੀਸਾਂ ਮਿਲਦੀਆਂ ਹਨ